ਮੈਂ ਬਹੁਤ ਤਰ੍ਹਾਂ ਦੇ ਪਕਵਾਨ ਬਣਾਉਂਦੀ ਹਾਂ ਪਰ ਮੈਂ ਇੱਕ ਸਪੈਸ਼ਲ ਜੋ ਕਿ ਮਸਾਲਾ ਤਿਆਰ ਕੀਤਾ ਹੋਇਆ ਹੈ ਜਿਸ ਵਿੱਚ ਮੈਂ ਦਾਲਚੀਨੀ ਸੌਂਫ਼ ਅਜਵਾਇਣ ਵੱਡੀ ਇਲਾਇਚੀ ਛੋਟੀ ਇਲਾਇਚੀ ਸਭ ਕੁਛ ਪਾ ਕੇ ਇੱਕ ਸਪੈਸ਼ਲ ਕਿਸਮ ਦਾ ਮਸਾਲਾ ਬਣਾਇਆ ਹੋਇਆ ਹੈ ਜੋ ਮੇਰੇ ਖਾਣੇ ਨੂੰ ਹੋਰ ਸਵਾਦ ਬਣਾ ਦਿੰਦਾ ਹੈ ਮੈਂ ਇਸ ਨੂੰ ਹਰ ਇੱਕ ਸਬਜ਼ੀ ਵਿੱਚ ਯੂਜ ਕਰ ਲੈਂਦੀ ਹਾਂ ਉਸ ਨਾਲ ਉਹ ਸਬਜ਼ੀ ਦਾ ਟੇਸਟ ਹੀ ਅਲੱਗ ਹੋ ਜਾਂਦਾ ਹੈ ਇਸਨੂੰ ਮੈਂ ਜਿਵੇਂ ਕੜਾਹੀ ਪਨੀਰ ਮਟਰ ਪਨੀਰ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਵਿੱਚ ਇਸਤੇਮਾਲ ਕਰਦੀ ਹਾਂ ਅਤੇ ਸਬਜ਼ੀਆਂ ਬਹੁਤ ਜ਼ਿਆਦਾ ਸਵਾਦ ਬਣਦੀਆਂ ਹਨ ਅਤੇ ਸਾਰੇ ਉਸ ਨੂੰ ਬਹੁਤ ਪਸੰਦ ਕਰਦੇ ਹਨ